ਸਾਡੀ ਰਸੋਈ ਦੇ ਵਿੱਚ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਸਾਡੀ ਰਸੋਈ ਵਿੱਚ ਸਭ ਤੋਂ ਪਹਿਲਾਂ ਤਾਂ ਬਿਜਲੀ ਚੁੱਲ੍ਹਾ ਜਿਸਨੂੰ ਅਸੀਂ ਇੰਡਕਸ਼ਨ ਵੀ ਕਹਿੰਦੇ ਹਾਂ ਮਿਕਸਰ ਜਿਸਨੂੰ ਅਸੀਂ ਮਿਕਸੀ ਦੇ ਨਾਂ ਨਾਲ ਵੀ ਜਾਣਦੇ ਹਾਂ ਗ੍ਰਾਈਂਡਰ ਗੈਸ ਸਿਲੰਡਰ ਓਵਨ ਇਹ ਉਪਕਰਨ ਸਾਡੀ ਰਸੋਈ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਜੇ ਆਪਾਂ ਪੁਰਾਣੇ ਦਿਨਾਂ ਦੀ ਗੱਲ ਕਰੀਏ ਤਾਂ ਪੁਰਾਣੇ ਦਿਨਾਂ ਦਿਨਾਂ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਇੱਕ ਚੁੱਲ੍ਹਾ ਇੱਕ ਤਵਾ ਚੱਕਲਾ ਵੇਲਣਾ ਇਹੀ ਸਾਡੇ ਉਪਕਰਨ ਹੁੰਦੇ ਸਨ ਜੋ ਕਿ ਅੱਜ ਦੇ ਦਿਨਾਂ ਨਾਲੋਂ ਬਹੁਤ ਜ਼ਿਆਦਾ ਵੱਖਰੇ ਹੋ ਚੁੱਕੇ ਹਨ ਅੱਜ ਦੇ ਟਾਈਮ 'ਚ ਅਸੀਂ ਪੁਰਾਣੇ ਉਪਕਰਨਾਂ ਨੂੰ ਭੁੱਲ ਕੇ ਨਵੇਂ ਉਪਕਰਨ ਕਿਉਂ ਚੁਣੇ ਹਨ ਇਸ ਦਾ ਸਭ ਤੋਂ ਵੱਡਾ ਉੱਤਰ ਜੋ ਕੀ ਹੈ ਉਹ ਹੈ ਸੌਖ ਕਿਉਂਕਿ ਹੁਣ ਤਕਨੀਕੀ ਯੁੱਗ ਦੇ ਵਿੱਚ ਹਰ ਕੋਈ ਸੌਖਾ ਰਹਿ ਕੇ ਜ਼ਿਆਦਾ ਖੁਸ਼ ਹੈ ਜੋ ਮਿਕਸਰ ਹੈ ਮਿਕਸਰ ਨੇ ਅਸੀਂ ਕੂੰਡਾ ਅਤੇ ਘੋਟਣਾ ਰਿਪਲੇਸ ਕੀਤਾ ਹੈ ਕੂੰਡੇ ਘੋਟਣੇ 'ਚ ਅਸੀਂ ਕੋਈ ਵੀ ਚੀਜ਼ ਰਗੜਦੇ ਤਾਂ ਉਸ ਦਾ ਅਸੀ ਕੂੰਡੇ ਅਤੇ ਘੋਟਣੇ ਦੀ ਵਰਤੋਂ ਕਰਦੇ ਜੋ ਕਿ ਅੱਜ ਕੱਲ੍ਹ ਦੀ ਜਗ੍ਹਾ ਮਿਕਸਰ ਨੇ ਲੈ ਲਈ ਹੈ ਇਸੇ ਤਰ੍ਹਾਂ ਨੇ ਜੀ ਚੁੱਲ੍ਹੇ ਦੀ ਜਗ੍ਹਾ ਗੈਸ ਸਿਲੰਡਰ ਨੇ ਲੈ ਲਈ ਤੰਦੂਰ ਦੀ ਜਗ੍ਹਾ ਓਵਨ ਨੇ ਲੈ ਲਈ ਇਹ ਸਾਰੇ ਉਪਕਰਨ ਜੋ ਅੱਜ ਦੇ ਟਾਈਮ ਵਿੱਚ ਅਸੀਂ ਲਿਆਉਂਦੇ ਗਏ ਹਨ ਇਹ ਸਾਡੇ ਇੱਕ ਤਕਨੀਕੀ ਦਾ ਤਜਰਬੇ ਦੇ ਤਕਨੀਕੀ ਦੇ ਅਵਿਸ਼ਕਾਰ ਹਨ ਜੋ ਕਿ ਸਾਨੂੰ ਅੱਜ ਦੇ ਯੁੱਗ ਦੀ ਦੇਣ ਹੈ ਹਾਂ ਇਸਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਫਾਇਦੇ ਇਹ ਹਨ ਕਿ ਇਹ ਟਾਈਮ ਬਹੁਤ ਘੱਟ ਲੈਂਦੇ ਹਨ ਜਿੱਦਾਂ ਆਪਾਂ ਮਿਕਸੀ ਦੀ ਗੱਲ ਕਰੀਏ ਅਤੇ ਅੱਧੇ ਘੰਟੇ ਦਾ ਕੰਮ ਪੰਜ ਮਿੰਟਾਂ ਦੇ ਵਿੱਚ ਕਰ ਦਿੰਦੀ ਹੈ ਪਰ ਇਸ ਦੇ ਨੁਕਸਾਨ ਵੀ ਹਨ ਜੇ ਆਪਾਂ ਗੱਲ ਕਰੀਏ ਪਹਿਲਾਂ ਅਸੀਂ ਕੂੰਡਾ ਘੋਟਣਾ ਵਰਤਦੇ ਸੀ ਜਿਹਦੇ ਵਿੱਚ ਘੋਟਣਾ ਨਿੰਮ ਦਾ ਹੁੰਦਾ ਸੀ ਅਤੇ ਕੂੰਡਾ ਪੱਥਰ ਦਾ ਹੁੰਦਾ ਸੀ ਜਿਸਦੇ ਕਿ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਸਨ ਜੋ ਕਿ ਅੱਜ ਦੇ ਇਹ ਉਪਕਰਨ ਨਹੀਂ ਦੇ ਸਕਦੇ ਧੰਨਵਾਦ